ਮੈਂ ਆਪਣੇ ਪਸੰਦ ਦਾ ਕੁੜਤਾ ਖਰੀਦਣ ਲਈ ਦੇਖਾਂਗੀ ਕਿ ਮੈਨੂੰ ਰੰਗ ਵੀ ਅੱਛਾ ਵਾ ਰੰਗ ਫੇਂਟ ਨਾ ਹੋਵੇ ਕਿ ਮੈਂ ਦੇਖਾਂਗੀ ਕਿ ਮੈਨੂੰ ਇਹ ਕੁੜਤਾ ਪੂਰਾ ਪੂਰਾ ਹੈ ਕਿ ਮੈਂ ਉਹਨੂੰ ਲਗਾ ਕੇ ਦੇਖਾਂਗੀ ਆਪਣੇ ਉੱਪਰ ਅਤੇ ਵੀ ਮੈਨੂੰ ਅਕਾਰ 'ਚ ਰੰਗ 'ਚ ਬਿਲਕੁਲ ਸਹੀ ਆ ਰਿਹਾ ਵਾ ਕਿ ਮੇਰੇ 'ਤੇ ਜੱਚਦਾ ਵਾ ਕਿ ਨਹੀਂ ਜੱਚਦਾ ਅਤੇ ਮੈਂ ਦੇਖਾਂਗੀ ਓੱਥੇ ਆਪਣਾ ਖਰੀਦਣ ਵਾਸਤੇ ਕਿ ਮੈਨੂੰ ਇਹ ਸਾਈਜ ਪੂਰਾ ਵਾ ਕਿ ਨਹੀਂ ਕਿ ਇਹ ਦੇਖਾਂਗੀ ਕਿ ਮੈਂ ਕਿ ਇਹਦੇ ਨੀਚੇ ਰੀਵਿਊ ਕਿੱਦਾਂ ਦੇ ਆ ਕੇ ਮੈਂ ਇਹ ਅੱਛਾ ਖਰੀਦਿਆ ਗਿਆ ਵਾ ਲੋਕਾਂ ਨੇ ਹੋਰਾਂ ਨੇ ਖਰੀਦਿਆ ਵਾ ਅਤੇ ਕੀ ਮੈਂ ਪੁੱਛਾਂਗੀ ਉਨ੍ਹਾਂ ਨੂੰ ਕਿ ਇਹ ਹੋਰ ਵੀ ਵਿਕੇ ਆ ਜਿਸ ਤਰ੍ਹਾਂ ਕਿ ਮੈਂ ਖਰੀਦਣਾ ਚਾਹੁੰਦੀ ਹਾਂ ਇਹਦਾ ਰੰਗ ਤਾਂ ਨਹੀਂ ਉੱਤਰੂਗਾ ਕਿ ਅੱਛਾ ਵਾ ਕੇ ਕੱਪੜਾ ਅੱਛਾ ਵਾ ਕਿਹੜੀ ਕਵਾਲਟੀ ਦਾ ਕੱਪੜਾ ਵਾ ਮੈਨੂੰ ਚੁਭੂਗਾ ਤਾਂ ਨਹੀਂ ਹੈ ਨਾ ਵੀ ਮਤਲਬ ਮੈਂ ਕੀ ਵਧੀਆ ਤਰੀਕੇ ਨਾਲ ਉਹਨੂੰ ਖਰੀਦੂੰਗੀ